ਮੈਨੂੰ ਮਨਾਲੀ ਜਾਣਾ ਬਹੁਤ ਪਸੰਦ ਹੈ ਕਿਉਂਕਿ ਇੱਥੇ ਪਹਾੜੀ ਇਲਾਕਾ ਹੈ ਅਤੇ ਬਹੁਤ ਹੀ ਵਧੀਆ ਦਿਨ ਅਤੇ ਰਾਤ ਬਤੀਤ ਹੁੰਦੀ ਹੈ